ਹੈਲੋ ਤੁਸੀ ਫਲਿੱਪਕਾਰਟ ਤੋਂ ਬੋਲ ਰਹੇ ਹੋ ਬਿੰਦੀਆਂ ਬੋਲ ਰਹੀ ਹਾਂ ਮੈਂ ਲਾਸਟ ਵੀਕ ਇੱਕ ਔਡਰ ਪਲੇਸ ਕੀਤਾ ਸੀਗਾ ਇਲੈਕਟ੍ਰਿਕ ਹੈੱਡਫੋਨਸ ਦਾ ਅਤੇ ਉਹ ਮੈਨੂੰ ਹੈੱਡਫੋਨਸ ਚਾਹੀਦੇ ਸੀ ਮੈਂ ਹੈੱਡਫੋਨਸ ਦੀ ਓਪਸ਼ਨ ਦੇਖੀ ਉੱਥੇ ਅਤੇ ਮੈਨੂੰ ਸਪੈਸੀਫਿਕ ਜੋ ਵੀ ਅ ਕੁਆਲਿਟੀਜ਼ ਚਾਹੀਦੀਆਂ ਸੀ ਮੈਨੂੰ ਉਹ ਹੈੱਡਫੋਨ 'ਚ ਦਿਖੀਆਂ ਅਤੇ ਮੈਂ ਉਹ ਔਡਰ ਪਲੇਸ ਕਰ ਦਿੱਤਾ ਅਤੇ ਮੈਨੂੰ ਲੱਗਾ ਸੀ ਕਿ ਹੈੱਡਫੋਨ ਚਾਰ ਪੰਜ ਦਿਨ ਦੇ ਵਿੱਚ ਡਿਲੀਵਰ ਹੋਣਗੇ ਬਟ ਫਲਿੱਪਕਾਰਟ ਵਾਲਿਆਂ ਦੀ ਸਰਵਿਸਿਸ ਬਹੁਤ ਅੱਛੀ ਸੀ ਉਹਨਾਂ ਨੇ ਮੈਨੂੰ ਨੈਕਸਟ ਡੇ ਹੀ ਸਰਵਿਸ ਪ੍ਰੋਵਾਈਡ ਕਰ ਦਿੱਤੀ ਅਤੇ ਫਲਿੱਪ ਹੈੱਡਫੋਨਸ ਮੇਰੇ ਕੋਲ ਆ ਗਏ ਅਤੇ ਮੈਨੂੰ ਪੇਮੈਂਟ 'ਚ ਪੇਮੈਂਟ ਕਰਨ ਵਿੱਚ ਵੀ ਕੋਈ ਦਿੱਕਤ ਨਹੀਂ ਆਈ ਔਨਲਾਈਨ ਪੇਮੈਂਟ ਹੀ ਮੈਂ ਪੇਅ ਕਰ ਦਿੱਤਾ ਸੀ ਅਤੇ ਉਹ ਅਕਾਊਟ ਚੋਂ ਹੀ ਡਿਡਕਟ ਹੋ ਗਏ ਸੀ ਪੈਸੇ ਅਤੇ ਅਕਾ ਹੈੱਡਫੋਨਸ ਬਹੁਤ ਅੱਛੇ ਸੀ ਉਹਨਾਂ ਦੀ ਕੁਆਲਿਟੀ ਵੀ ਬਹੁਤ ਅੱਛੀ ਹੈ ਦੇਖਣ 'ਚ ਵੀ ਬਹੁਤ ਸਟਾਈਲਿਸ਼ ਨੇ ਅਤੇ ਲਾਈਟ ਵੇਟ ਨੇ ਕੈਰੀ ਕਰਨੇ ਵੀ ਬਹੁਤ ਈਜ਼ੀ ਨੇ ਅਤੇ ਉਹਨਾਂ ਦੀ ਕੁਆਲਿਟੀ ਵੀ ਬਹੁਤ ਅੱਛੀ ਸੀਗੀ ਫਲਿੱਪਕਾਰਟ ਵਾਲਿਆਂ ਦੀ ਸਰਵਿਸਿਸ ਬਹੁਤ ਅੱਛੀਆਂ ਸੀ ਉਹ ਤੋਂ ਬਾਅਦ ਮੈਨੂੰ ਔਡਰ ਪਲੇਸ ਕਰਨ ਤੋਂ ਬਾਅਦ ਮੈਨੂੰ ਰਿਵੋਰਡ ਮਿਲਿਆ ਰਿਵੋਰਡ 'ਚ ਮੈਨੂੰ ਔਫਰ ਮਿਲੀ ਹੋਰ ਕਿ ਮੈਂ ਹੋਰ ਬਾਏ ਕਰਾਂਗੀ ਅਤੇ ਮੈਨੂੰ ਹੋਰ ਪ੍ਰੋਡਕਟਸ ਔਫਰਸ ਮਿਲਣਗੀਆਂ ਅਤੇ ਫਲਿੱਪਕਾਰਟ ਦੀ ਸਰਵਿਸਿਸ ਮੈਨੂੰ ਬਹੁਤ ਅੱਛੀਆਂ ਲੱਗੀਆਂ ਥੈਂਕ ਯੂ ਫੋਰ ਯੂਅਰ ਸਰਵਿਸਿਸ